ਚਿੱਤਰਕਾਰੀ ਹੱਥਾਂ ਦੀ ਉਹ ਪੈਦਾਇਸ਼ ਹੈ ਜਿਸ ਨਾਲ ਆਪਾਂ ਦੁਨੀਆਂ ਨੂੰ ਆਪਣੇ ਨਜ਼ਰੀਏ ਤੋਂ ਦੇਖ ਸਕਦੇ ਹਾਂ ਮੈਂ ਆਪਣੀ ਚਿੱਤਰਕਾਰੀ ਨੂੰ ਬਿਹਤਰ ਬਣਾਉਣ ਲਈ ਬਹੁਤ ਸਾਰੇ ਬਹੁਤ ਸਾਰੀਆਂ ਤਕਨੀਕਾਂ ਦੀ ਮਦਦ ਲਿੱਤੀ ਏ ਜਿੱਦਾਂ ਮਨੁੱਖੀ ਐਨਟੋਮੀ ਨੂੰ ਸਿੱਖਣਾ ਜਿਸ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਮਨੁੱਖੀ ਸਰੀਰ ਕਿਸ ਤਰ੍ਹਾਂ ਬਣਦਾ ਹੈ ਅਤੇ ਕੰਮ ਕਰ ਸਕਦਾ ਹੈ ਮਨੁੱਖੀ ਐਨਟੋਮੀ ਨੂੰ ਸਿੱਖਣ ਲਈ ਮੈਂ ਯੂਟੀਊਬ 'ਤੇ ਬਹੁਤ ਸਾਰੇ ਕੋਰਸਿਸ ਵਗੈਰਾ ਦੇਖੇ ਫਰੀ ਕੋਰਸਿਸ ਅਤੇ ਹੋਰ ਚੀਜ਼ਾਂ ਵੀ ਹੈਗੀਆਂ ਨੇ ਜਿੱਦਾਂ ਆਪਣੇ ਡਰਾਇੰਗ ਚਿੱਤਰਕਾਰੀ ਦੇ ਮੀਡੀਅਮ ਨੂੰ ਚੇਂਜ ਕਰਨਾ ਮੀਡੀਅਮ ਯਾਨੀ ਕਿ ਤੁਸੀਂ ਕਿਸ ਨਾਲ ਚਿੱਤਰਕਾਰੀ ਕਰ ਰਹੇ ਹੋ ਕਿ ਉਹ ਪੇਂਟ ਬ੍ਰਸ਼ ਹੈਗੇ ਨੇ ਜਾਂ ਉਹ ਕਰਿਓਨਸ ਹੈਗੇ ਨੇ ਜਾਂ ਉਹ ਓਇਲ ਪੇਸਟਲਸ ਹੈਗੇ ਨੇ ਚਿੱਤਰਕਾਰੀ ਨੂੰ ਜਿੰਨਾ ਵੀ ਐਕਸਪਲੋਰ ਕੀਤਾ ਜਾਵੇ ਉੱਨਾਂ ਉਸਨੂੰ ਵਧੀਆ ਬਣਾਇਆ ਜਾ ਸਕਦਾ ਏ ਇੱਕ ਚਿੱਤਰਕਾਰ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਤਕਨੀਕਾਂ ਸਿੱਖਦਾ ਹੈ ਪਰ ਸਭ ਤੋਂ ਵਧੀਆ ਤਕਨੀਕ ਜਿਹਦੇ ਨਾਲ ਪਤਾ ਲੱਗਦਾ ਹੈ ਕਿ ਚਿੱਤਰਕਾਰੀ ਸਾਡੀ ਇੱਕ ਉੱਤੇ ਲੈ ਕੇ ਕਿੱਦਾਂ ਜਾ ਸਕਦੇ ਹਾਂ ਉਹ ਹੈਗੀ ਆ ਐਨਟੋਮੀ ਸਿੱਖਣਾ ਅਤੇ ਲੈਟ ਅਤੇ ਅਤੇ ਸ਼ੈਡੋਜ ਨੂੰ ਪੜ੍ਹਨਾ ਕਿ ਕਿਸ ਤਰ੍ਹਾਂ ਕਿਹੜੀ ਚੀਜ਼ 'ਤੇ ਕਿਸ ਤਰ੍ਹਾਂ ਰੌਸ਼ਨੀ ਪੈ ਰਹੀ ਹੈ ਅਤੇ ਉਹ ਪੇਪਰ 'ਤੇ ਉਹ ਕਾਗਜ਼ 'ਤੇ ਕਿਸ ਕਿਸ ਤਰ੍ਹਾਂ ਦਿਖੇਗੀ ਇਹਨਾਂ ਤਕਨੀਕਾਂ ਨੂੰ ਸਿੱਖਣ ਲਈ ਔਨਲਾਈਨ ਬਹੁਤ ਸਾਰੇ ਕੋਰਸ ਹੈਗੇ ਯੂਟੀਊਬ 'ਤੇ ਤੁਹਾਨੂੰ ਹਜ਼ਾਰੋਂ ਕੋਰਸ ਮਿਲ ਜਾਣਗੇ ਉਹ ਵੀ ਫਰੀ ਕੁਝ ਕੋਰਸ ਪੇਡ ਵੀ ਹੋਣਗੇ ਪਰ ਉਹ ਯੂਟੀਊਬ 'ਤੇ ਨਹੀਂ ਪਲੇਅ ਸਟੋਰ 'ਚੋਂ ਐਪਾਂ 'ਚੋਂ ਮਿਲਣਗੇ ਬਸ ਇਸ ਤਰ੍ਹਾਂ ਹੀ ਪੂਰਾ ਦਾ ਪੂਰਾ ਸਿਸਟਮ ਸੈਟ ਹੋ ਜਾਏਗਾ